ਪੰਜਾਬ ਵਿੱਚ ਮੀਡੀਆ ਕਈ ਨਿਯਮਾਂ ਦੀਆਂ ਪਾਲਣਾ ਕਰਦੀਆਂ ਉਹਨਾਂ ਵਿੱਚ ਸ ਮੇਨ ਸ਼ੁੱਧਤਾ ਨਿਰਪੱਖਤਾ ਸੁਤੰਤਰਤਾ ਹਨ ਕ ਕਈ ਮੀਡੀਆ ਅੱਜ ਕੱਲ ਵਿਕ ਵਿਕ ਵੀ ਚੁੱਕੇ ਹਨ ਪਰ ਹੁ ਹੁਣ ਅੱਜ ਕੱਲ ਦੇ ਜ਼ਮਾਨੇ ਵਿੱਚ ਲੋਕ ਇੰਨੇ ਅਵੇਅਰ ਹੋ ਗਏ ਹਨ ਕਿ ਉਹਨਾਂ ਨੂੰ ਸਭ ਕੁਛ ਪਤਾ ਹੈ ਹੁਣ ਮੀਡੀਆ ਵਾਲੇ ਸ ਲੋਕਾਂ ਨੂੰ ਸਹੀ ਖਬਰਾਂ ਦਿੰਦੇ ਹਨ ਜਿਵੇਂ ਉਹ ਆਪਣੇ ਚੈਨਲ ਵਿੱਚ ਸੁਤੰਤਰ ਹੁੰਦੇ ਹਨ ਉਹ ਹਮੇਸ਼ਾ ਸਹੀ ਲੋਕਾਂ ਨੂੰ ਉਹ ਚੀਜ਼ ਦਿਖਾਉਂਦੇ ਹਨ ਜੋ ਸਮਾਜ ਵਿੱਚ ਘਟਿਤ ਹੋ ਰਿਹਾ ਹੈ ਜੋ ਚੱਲ ਰਿਹਾ ਹੈ ਉਹ ਆਪਣੇ ਕੋਲੋਂ ਕੁਝ ਵੀ ਨਹੀਂ ਕਰ ਰਹੇ ਉਹ ਆਪਣੇ ਚੈਨਲ ਦੀ ਪਾਪੂਲਿਟੀ ਵਧਾਉਣ ਵਾਸਤੇ ਨਹੀਂ ਕੁਛ ਕਰਦੇ ਉਹ ਲੋਕਾਂ ਨੂੰ ਜਾਗਰੂਕਤ ਕਰਨ ਵਾਸਤੇ ਹੀ ਚੈ ਨਿਊਜ਼ ਦਿਖਾਉਂਦੇ ਹਨ ਨਿਰਪੱਖਤਾ ਨਾਲ ਨਿਊਜ਼ ਦਿਖਾਉਂਦੇ ਹਨ ਸੁਤੰਤਰ ਹੋ ਕੇ ਸ਼ੁੱਧ ਨਿਊਜ਼ ਦਿਖਾਉਂਦੇ ਹਨ ਉਹ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਦੇ ਪ ਮੀਡੀਆ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਲੋਕ ਜੁੜ ਕੇ ਆਪਣੇ ਆਪ ਦੇ ਵਿੱਚ ਗਿਆਨ ਵਧਾਉਂਦੇ ਹਨ ਮੀਡੀਆ ਦੇ ਦੇਸ਼ ਦਾ ਇੱਕ ਅਜਿਹਾ ਸਾਧਨ ਹੈ ਜੋ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਜ਼ਿਆਦਾ ਲਾਹੇਵੰਦ ਸਾਬਤ ਹੋਇਆ ਹੈ ਇਸ ਲਈ ਮੀਡੀਆ ਨੂੰ ਹੀ ਸਭ ਤੋਂ ਅੱਗੇ ਰੱਖਿਆ ਜਾਂਦਾ ਹੈ